ਸਾਹਿਤ ਕਵਿਤਾ ਅਤੇ ਕਲਾਤਮਕ ਪ੍ਰਗਟਾਵੇ ਦੇ ਰੂਪਾਂ ਵਿੱਚ ਪੰਜਾਬੀ ਭਾਸ਼ਾ ਦੀ ਵਰਤੋਂ ਸਿਰਫ ਇਨ੍ਹਾਂ ਵਿੱਚ ਹੀ ਨਹੀਂ ਹੁੰਦੀ ਸਾਡੀ ਜਿਹੜੀ ਆਮ ਬੋਲਚਾਲ ਦੀ ਰੋਜ਼ਨਾ ਦੀ ਭਾਸ਼ਾ ਹੈ ਅਸੀਂ ਉਹਦੇ ਵਿੱਚ ਵੀ ਪੰਜਾਬੀ ਵਿੱਚ ਹੀ ਗੱਲ ਬਾਤ ਕਰਦੇ ਹਾਂ ਜਦ ਕਿਸੇ ਨਾਲ ਵੀ ਕੋਈ ਗੱਲਬਾਤ ਕਰਨੀ ਹੁੰਦੀ ਹੈ ਤਾਂ ਅਸੀਂ ਪੰਜਾਬੀ ਵਿੱਚ ਹੀ ਗੱਲਬਾਤ ਕਰਦੇ ਹਾਂ ਪੰਜਾਬੀ ਸਾਡੀ ਮਾਂ ਬੋਲੀ ਹੈ ਅਤੇ ਜਿਹੜੇ ਸਾਡੇ ਧਾਰਮਿਕ ਗ੍ਰੰਥ ਲਿਖੇ ਹੋਏ ਨੇ ਉਹ ਵੀ ਪੰਜਾਬੀ ਭਾਸ਼ਾ ਵਿੱਚ ਹੀ ਲਿਖੇ ਹੋਏ ਨੇ ਸ਼ੁੱਧ ਪੰਜਾਬੀ ਭਾਸ਼ਾ ਵਿੱਚ ਲਿਖੇ ਹੋਏ ਨੇ ਜ਼ਿਆਦਾਤਰ ਸਾਨੂੰ ਸਕੂਲਾਂ ਵਿੱਚ ਜਿਹੜੇ ਜ਼ਿਆਦਾਤਰ ਸਬਜੈਕਟ ਹੁੰਦੇ ਹੈਂ ਸਾਡੇ ਉਹ ਵੀ ਪੰਜਾਬੀ ਭਾਸ਼ਾ ਵਿੱਚ ਹੀ ਹੁੰਦੇ ਨੇ ਅਤੇ ਸਕੂਲਾਂ ਵਿੱਚ ਤਾਂ ਇਹ ਨਿਸ਼ਚਿਤ ਵੀ ਕਰ ਦਿੱਤਾ ਗਿਆ ਹੈ ਜੇ ਕੋਈ ਪੰਜਾਬੀ ਵਿੱਚ ਫੇਲ੍ਹ ਹੈ ਤਾਂ ਉਹ ਪੰਜਾਬੀ ਵਿੱਚ ਫੇਲ੍ਹ ਹੈ ਤਾਂ ਉਹ ਸਾਰੇ ਸਬਜੈਕਟਾਂ ਵਿੱਚ ਫੇਲ੍ਹ ਹੀ ਮੰਨਿਆ ਜਾਂਦਾ ਉਹਨੂੰ ਅਤੇ ਜਿਹੜੇ ਸਾਡੇ ਅਖਬਾਰ ਆਉਂਦੇ ਨੇ ਅਤੇ ਜਿਹੜੇ ਸਾਡੇ ਅਖਬਾਰ ਆਉਂਦੇ ਹੈ ਰੋਜ਼ਾਨਾ ਅਸੀਂ ਪੜ੍ਹਦੇ ਹਾਂ ਉਹ ਵੀ ਜ਼ਿਆਦਾਤਰ ਪੰਜਾਬੀ ਵਿੱਚ ਹੀ ਆਉਂਦੇ ਨੇ ਅਤੇ ਜਿਹੜੇ ਸਾਡੇ ਪੁਰਾਣੇ ਬਜ਼ੁਰਗ ਨੇ ਅਤੇ ਉਹ ਕੋਈ ਹੋਰ ਭਾਸ਼ਾ ਵਿੱਚ ਜਿਨ੍ਹਾਂ ਨੂੰ ਹੋਰ ਭਾਸ਼ਾ ਦਾ ਕੋਈ ਗਿਆਨ ਨਹੀਂ ਹੈਗਾ ਉਹ ਉਹ ਵੀ ਸਿਰਫ ਪੰਜਾਬੀ ਵਿੱਚ ਹੀ ਸਮਝਦੇ ਨੇ ਕੁਛ ਵੀ ਕੁਛ ਵੀ ਗੱਲਬਾਤ ਹੁੰਦੀ ਹੈ ਤਾਂ ਉਨ੍ਹਾਂ ਨੂੰ ਸਿਰਫ ਪੰਜਾਬੀ ਵਿੱਚ ਹੀ ਸਮਝ ਆਉਂਦੀ ਹੈ ਤਾਂ ਅਸੀਂ ਜ਼ਿਆਦਾਤਰ ਉਨ੍ਹਾਂ ਨੂੰ ਸਮਝਾਉਂਦੇ ਕਰਕੇ ਵੀ ਜਾਂ ਹੋਰ ਕੋਈ ਗੱਲਬਾਤ ਖਾਤਰ ਵੀ ਅਸੀਂ ਜ਼ਿਆਦਾਤਰ ਪੰਜਾਬੀ ਉਹ ਬੋਲ਼ਦੇ ਹਾਂ ਤਾਂ ਕਿ ਸਾਰਿਆਂ ਨੂੰ ਸਮਝ ਆ ਸਕੇ ਕਿ ਜਿਹੜਾ ਸਾਡਾ ਕਲਚਰ ਹੈ ਸਾਡਾ ਪੁਰਾਣਾ ਕਲਚਰ ਹੈ ਸਾਡੇ ਭੰਗੜੇ ਵਗੈਰਾ ਗਾਣੇ ਗੀਤ ਵਗੈਰਾ ਉਹ ਸਾਰੇ ਪੰਜਾਬੀ 'ਚ ਨੇ ਅਤੇ ਅਸੀਂ ਉਨ੍ਹਾਂ ਨਾਲ ਵੀ ਥੋੜ੍ਹਾ ਜਿਹਾ ਇੰਨਜੁਆਏਮੈਂਟ ਕਰਦੇ ਹਾਂ ਅਤੇ ਜਿਹੜੇ ਟੀਵੀ ਵਿੱਚ ਪ੍ਰੋਗਰਾਮ ਆਉਂਦੇ ਹੈ ਪੰਜਾਬੀ ਵਿੱਚ ਅਤੇ ਸਾਨੂੰ ਤਾਂ ਹੀ ਸਾਡੇ ਹਰੇਕ ਬੰਦੇ ਨੂੰ ਪੰਜਾਬ ਦੇ ਤਾਂ ਉਹ ਸਾਰੇ ਹਰੇਕ ਪੰਜਾਬੀ ਨੂੰ ਪੰਜਾਬੀ ਵਿੱਚ ਹੀ ਸਮਝ ਸਮਝ ਆਉਂਦੇ ਹੈ ਹੋਰ ਕਿਸੇ ਭਾਸ਼ਾ ਵਿੱਚ ਜ਼ਿਆਦਾ ਸਮਝ ਨਹੀਂ ਆਉਂਦੀ ਹੈ ਅਤੇ ਜਿਹੜੇ ਨੇਤਾ ਕੋਈ ਵੀ ਕੋਈ ਭਾਸ਼ਣ ਦਿੰਦਾ ਤਾਂ ਅਸੀਂ ਸੁਣਦੇ ਹਾਂ ਤਾਂ ਉਹ ਸਾਡੇ ਨੇਤਾ ਵੀ ਸਾਰੇ ਪੰਜਾਬੀ ਨੇ ਤਾਂ ਪੰਜਾਬੀ ਵਿੱਚ ਹੀ ਉਹ ਭਾਸ਼ਣ ਦਿੰਦੇ ਹੈ ਅਤੇ ਸਾਨੂੰ ਉਨ੍ਹਾਂ ਦੀ ਜਿਹੜੀ ਗੱਲਬਾਤ ਹੈ ਜ਼ਿਆਦਾ ਬਿਹਤਰ ਤਰੀਕੇ ਨਾਲ ਸਾਨੂੰ ਪੰਜਾਬੀ ਵਿੱਚ ਹੀ ਸਮਝ ਆਉਂਦੀ ਹੈ ਹੋਰ ਭਾਸ਼ਾ ਕਿਸੇ ਵਿੱਚ ਸਮਝ ਨਹੀਂ ਆਉਂਦੀ ਜਿਹੜੀਆਂ ਸਾਡੀਆਂ ਸਾਹਿਤਕ ਕਵਿਤਾਵਾਂ ਕਲਾਤਮਕ ਇਹ ਤਾਂ ਸਾਡੇ ਹੈ ਹੀ ਇਹੋ ਹੈ ਸਾਰੇ ਪੰਜਾਬੀ ਵਿੱਚ ਅਤੇ ਜਿਹੜੇ ਹੋਰ ਅਸੀਂ ਕੁਛ ਵੀ ਕਰਨਾ ਤਾਂ ਜਿਹੜੇ ਸਾਨੂੰ ਬੋਲ਼ਣ ਵਿੱਚ ਸੌਖੀ ਵੀ ਲੱਗਦੀ ਹੈ ਜਿਹੜੀ ਅਸੀਂ ਬਚਪਨ ਤੋਂ ਬੋਲ਼ਦੇੇ ਆ ਰਹੇ ਹਾਂ ਸਾਨੂੰ ਉਹੀ ਭਾਸ਼ਾ ਸਾਡੀ ਪੰਜਾਬੀ ਹੈ ਅਤੇ ਸਾਨੂੰ ਪੰਜਾਬੀ ਵਿੱਚ ਹੀ ਗੱਲਬਾਤ ਕਰਨੀ ਬਹੁਤ ਵਧੀਆ ਲੱਗਦੀ ਹੈ ਅਤੇ ਸਾਡੀ ਪੰਜਾਬੀ ਨੂੰ ਅਸੀਂ ਹੋਰ ਵੀ ਚਾਹੁੰਦੇ ਹਾਂ ਵੀ ਜਿਹੜੇ ਹੋਰ ਵੀ ਕੋਈ ਕੰਟਰੀਆਂ ਹੈ ਉਹਨਾਂ ਵਿੱਚ ਸਾਡੇ ਜਿਹੜੇ ਪੰਜਾਬੀ ਭੈਣ ਭਾਈ ਗਏ ਹੋਏ ਨੇ ਅਤੇ ਉਨ੍ਹਾਂ ਦੇ ਅਗਾਂਹ ਬੱਚੇ ਨੇ ਜਿਨ੍ਹਾਂ ਨੂੰ ਨਹੀਂ ਆਉਂਦੀ ਅਸੀਂ ਉਨ੍ਹਾਂ ਨੂੰ ਵੀ ਇਹ ਕਹਿਣਾ ਚਾਹੁੰਦੇ ਹਾਂ ਵੀ ਉਨ੍ਹਾਂ ਨੂੰ ਵੀ ਸਿੱਖਣੀ ਚਾਹੀਦੀ ਹੈ ਆਪਣੇ ਮਾਂ ਪਿਓ ਤੋਂ ਪੰਜਾਬੀ ਕਿਉਂਕਿ ਜੇਕਰ ਉਹ ਕਦੇ ਪੰਜਾਬ ਆਉਣ ਤਾਂ ਪੰਜਾਬ 'ਚ ਆ ਕੇ ਕਿਸੇ ਨਾਲ ਗੱਲਬਾਤ ਕਰਨ ਤਾਂ ਉਨ੍ਹਾਂ ਨੂੰ ਪਤਾ ਲੱਗੇ ਇੱਧਰ ਵਾਲਿਆਂ ਨੂੰ ਵੀ ਸਮਝ ਆਵੇ ਵੀ ਹਾਂ ਇਹ ਸਾਡੇ ਪੰਜਾਬ ਦੇ ਬੰਦੇ ਨੇ ਉੱਧਰ ਰਹਿ ਰਹੇ ਨੇ ਅਤੇ ਕਿੰਨੀ ਵਧੀਆ ਪੰਜਾਬੀ ਬੋਲ਼ ਰਹੇ ਨੇ